ਮੈਂ ਬਹੁਤ ਹੀ ਥਾਵਾਂ 'ਤੇ ਗਈ ਹਾਂ ਜਿਵੇਂ ਕਿ ਪੰਜਾਬ ਵਿੱਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਹੋ ਗਿਆ ਅਤੇ ਗੁਰਦਾਸਪੁਰ ਹੋ ਗਿਆ ਹੈ ਨਾ ਅਨੰਦਪੁਰ ਸਾਹਿਬ ਹੋ ਗਿਆ ਅਤੇ ਪੰਜਾਬ ਤੋਂ ਬਾਹਰ ਹੋ ਗਿਆ ਜੰਮੂ ਹੋ ਗਿਆ ਕਸ਼ਮੀਰ ਹੋ ਗਿਆ ਸ਼੍ਰੀਨਗਰ ਹੈ ਨਾ ਇਹ ਸਾਰੀਆਂ ਥਾਵਾਂ 'ਤੇ ਘੁੰਮੀ ਅਤੇ ਹਰ ਇੱਕ ਥਾਂ ਦੀ ਆਪਣੀ ਆਪਣੀ ਖੂਬੀ ਹੈ ਠੀਕ ਹੈ ਜਿਵੇਂ ਕਿ ਅਸੀਂ ਅਨੰਦਪੁਰ ਸਾਹਿਬ ਚਲੇ ਜਾਈਏ ਹੈ ਨਾ ਉੱਥੇ ਵੀ ਸਾਨੂੰ ਬਹੁਤ ਸਾਰੇ ਗੁਰਦੁਆਰੇ ਦੇਖਣ ਨੂੰ ਮਿਲਦੇ ਹਨ ਅਤੇ ਹੈ ਨਾ ਆਪਾਂ ਬਹੁਤ ਸਾਰੇ ਧਾਮ ਦ ਦਰਸ਼ਨ ਕਰ ਸਕਦੇ ਗੁਰਦੁਆਰਿਆਂ ਦੇ ਅਤੇ ਅਨ ਆਪਣੇ ਅੰਮ੍ਰਿਤਸਰ ਸਾਹਿਬ ਅਤੇ ਹੋਰ ਵੀ ਕਈ ਮਿਊਜੀਅਮ ਹੈਗੇ ਆ ਹੈ ਨਾ ਆਪਣੇ ਦਰਬਾਰ ਸਾਹਿਬ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਹੈਗਾ ਹੈ ਨਾ ਉਹ ਸਥਿਤ ਹੈਗਾ ਅਤੇ ਉਹਦੀ ਆਪਣੀ ਖੂਬੀ ਹੈ ਉੱਥੇ ਅਸੀਂ ਆਪਾਂ ਸ਼ੋਪਿੰਗ ਵੀ ਕਰ ਸਕਦੇ ਹਾਂ ਖਰੀਦਦਾਰੀ ਲਈ ਵੀ ਬਹੁਤ ਅੱਛੀ ਜਗ੍ਹਾ ਹੈਗੀ ਹੈ ਲੁਧਿਆਣਾ ਜਿਵੇਂ ਉੱਥੇ ਵੀ ਸਾਨੂੰ ਜਿਹੜਾ ਹੈਗਾ ਖਰੀਦਦਾਰੀ ਲਈ ਬਹੁਤ ਹੀ ਸਸਤਾ ਪੈਂਦਾ ਹੈ ਉਸ ਕਰਕੇ ਉਹ ਲੁਧਿਆਣੇ ਦੀ ਇੱਕ ਆਪਣੀ ਖੂਬੀ ਹੈ ਅਗਰ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਦਾ ਮੌਸਮ ਜਿਹੜਾ ਹੈਗਾ ਆ ਹੈ ਨਾ ਬਹੁਤ ਹੀ ਖੂਬਸੂਰਤ ਹੈਗਾ ਅਤੇ ਉਹਦਾ ਆਪਣਾ ਹੀ ਇੱਕ ਅਲੱਗ ਆਨੰਦ ਹੈ ਅਤੇ ਹੋਰ ਬਾਕੀ ਹਰ ਇੱਕ ਜਗ੍ਹਾ ਦੀ ਆਪਣੀ ਆਪਣੀ ਖੂਬੀ ਹੁੰਦੀ ਹੈ ਠੀਕ ਹੈ ਜਿਵੇਂ ਕਿ ਉੱਥੇ ਸ਼੍ਰੀਨਗਰ ਦੇ ਵਿੱਚ ਮੌਸਮ ਬਹੁਤ ਹੀ ਠੰਡਾ ਪਾਇਆ ਜਾਂਦਾ ਹੈ ਬਰਫ ਦੇਖਣ ਨੂੰ ਤੁਹਾਨੂੰ ਮਿਲਦੀ ਹੈ ਹੈ ਨਾ ਝਰਨੇ ਵਾਦੀਆਂ ਸਾ ਇੰਨਾ ਕੁਛ ਦੇਖਣ ਨੂੰ ਮਿਲਦਾ ਆ